ਭੰਗੜਾ ਇੱਕ ਅਜਿਹਾ ਨਾਚ ਹੈ ਜੋ ਕਿ ਜੋਸ਼ ਦੇ ਫੁਰਤੀ ਨਾਲ ਮਸ਼ਹੂਰ ਹੈ ਇਹ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਇਸ ਨਾਲ ਭੰਗੜਾ ਪਾਉਣ ਵਾਲੇ ਦੇ ਅੰਦਰ ਇੱਕ ਅਲੱਗ ਹੀ ਖੁਸ਼ੀ ਅਤੇ ਰਚਨਾਤਮਕ ਭਾਵ ਪੈਦਾ ਹੁੰਦੇ ਹਨ ਇਹ ਸਰੀਰ ਦੀ ਤੰਦਰੁਸਤ ਰੱਖਣ ਵਿੱਚ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਨਾਲ ਸਰੀਰ ਸਦਾ ਗਤੀ ਕਰਦਾ ਹੈ ਅਤੇ ਸਾਡੇ ਹੱਥ ਪੈਰ ਲੱਤਾਂ ਬਾਹਾਂ ਹਿਲਦੀਆਂ ਰਹਿੰਦੀਆਂ ਹਨ ਹਨ ਜਿਸ ਨਾਲ ਖੂਨ ਦਾ ਪ੍ਰਸਾਰਨ ਸਹੀ ਤਰੀਕੇ ਨਾਲ ਹੁੰਦਾ ਹੈ ਭੰਗੜੇ ਨੂੰ ਪਾਉਣ ਲਈ ਕਾਫੀ ਅਭਿਆਸ ਦੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਭੰਗੜਾ ਰੈਬਿਕਸ ਨੂੰ ਸਿੱਖਣ ਦੀ ਸ਼ੁਰੂਆਤ ਕਰਦਾ ਹੈ ਤਾਂ ਸਾਨੂੰ ਉਸ ਨੂੰ ਇਹ ਸਲਾਹ ਦੇਣੀ ਚਾਹੀਦੀ ਹੈ ਕਿ ਉਸ ਨੂੰ ਪਹਿਲਾਂ ਬੇਸਿਕ ਸਿੱਖ ਅਤੇ ਰੋਜ਼ਾਨਾ ਗਾਣਿਆਂ 'ਤੇ ਵੱਖ ਵੱਖ ਭੰਗੜੇ ਦੇ ਸਟੈਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਆਪਣੀ ਪਰ ਪਰਫਾਰਮੈਂਸ ਦੀ ਵੀਡੀਓ ਰਿਕਾਰਡ ਕਰਕੇ ਆਪਣੇ